ਹਾਂਜੀ ਅਸੀਂ ਦੂਸਰੇ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਬਾਰੇ ਹੋਰ ਜਾਣਨ ਲਈ ਕੋਈ ਕਲਾ ਗੈਲਰੀਆਂ ਜਾਂ ਪ੍ਰਦਸ਼ਨੀਆਂ ਦਾ ਦੌਰਾ ਕਰਦੇ ਹਾਂ ਇਹ ਦੌਰਾ ਇਹ ਜਾਣਨ ਲਈ ਕੀਤਾ ਜਾਂਦਾ ਹੈ ਕਿ ਉਹ ਕਿੰਨਾ ਵਿਸਥਾਰ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਉਹਨਾਂ ਦੀਆਂ ਕਲਾਕ੍ਰਿਤੀਆਂ ਦੇਖਣ ਲਈ ਅਸੀਂ ਬਰਨਾਲੇ ਸੰਗਰੂਰ ਚੰਡੀਗੜ੍ਹ ਜਾਂ ਹੋਰ ਦੂਜੇ ਸ਼ਹਿਰਾਂ ਵਿੱਚ ਵੀ ਚਲੇ ਜਾਂਦੇ ਹਾਂ ਕਿਉਂਕਿ ਕਲਾ ਨੂੰ ਪਰਖਣਾ ਸਾਡੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਕਿਹੜਾ ਕਲਾਕਾਰ ਵਧੀਆ ਕਲਾ ਦਾ ਪ੍ਰਦਰਸ਼ਨ ਕਰਦਾ ਹੈ ਜਦੋਂ ਅਸੀਂ ਇਹਨਾਂ ਕਲਾਕਾਰਾਂ ਨੂੰ ਮਿਲਦੇ ਹਾਂ ਜੋ ਕਿ ਇਹ ਗੈਲਰੀਆਂ ਜਾਂ ਪ੍ਰਦਰਸ਼ਨੀਆਂ ਲਗਾਉਂਦੇ ਹਨ ਤਾਂ ਸਾਨੂੰ ਇੱਕ ਗੱਲ ਦੇਖਣ ਨੂੰ ਮਿਲਦੀ ਹੈ ਕਿ ਇਹਨਾਂ ਹਰੇਕ ਕਲਾਕਾਰ ਵਿੱਚ ਅਲੱਗ ਅਲੱਗ ਵਿਸ਼ੇਸ਼ਤਾ ਹੈ ਇਹਨਾਂ ਵਿੱਚ ਇੱਕ ਵਿਲੱਖਣ ਹੀ ਪ੍ਰਤਿਭਾ ਹੁੰਦੀ ਹੈ ਜੋ ਇਹਨਾਂ ਨੂੰ ਦੂਜਿਆਂ ਨਾਲੋਂ ਵੱਖ ਕਰਦੀ ਹੈ ਇਹ ਕਾਫ਼ੀ ਬੇਹਤਰੀਨ ਇਨਸਾਨ ਹੁੰਦੇ ਹਨ ਜੋ ਆਪਣੇ ਅੰਦਰਲੀ ਕਲਾ ਨੂੰ ਬਾਹਰਲੇ ਦੁਨੀਆਂ ਨਾਲ ਸਾਂਝਾ ਕਰ ਸਕਦੇ ਹਨ ਹਰੇਕ ਵਿਅਕਤੀ ਆਪਣੇ ਅੰਦਰਲੀ ਕਲਾ ਨੂੰ ਬਾਹਰਲੇ ਲੋਕਾਂ ਨਾਲ ਸਾਂਝਾ ਕਰਨ ਦੇ ਕਾਬਿਲ ਨਹੀਂ ਹੁੰਦਾ ਇਹ ਕਲਾਕਾਰਾਂ ਨੂੰ ਇੱਕ ਗੋਡ ਗਿਫਟ ਹੀ ਹੁੰਦਾ ਹੈ ਇੱਕ ਪਰਮਾਤਮਾ ਵੱਲੋਂ ਤੋਹਫ਼ਾ ਹੁੰਦਾ ਹੈ ਕਿ ਇਹ ਆਪਣੀ ਕਲਾ ਨੂੰ ਦੂਜੇ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਦੇ ਹਨ ਫਿਰ ਇਹ ਦੂਜੇ ਲੋਕਾਂ ਦੀ ਸਮਝ 'ਤੇ ਡਿਪੈਂਡ ਕਰਦਾ ਹੈ ਕਿ ਉਹ ਉਸ ਦੀ ਕਲਾ ਨੂੰ ਕਿਸ ਨਜ਼ਰੀਏ ਨਾਲ ਸਮਝਦੇ ਹਨ ਜਦੋਂ ਅਸੀਂ ਇਹਨਾਂ ਕਲਾਕਾਰਾਂ ਨੂੰ ਮਿਲਦੇ ਹਾਂ ਜੋ ਗੈਲਰੀਆਂ ਜਾਂ ਪ੍ਰਦਰਸ਼ਨੀਆਂ ਲਗਾਉਂਦੇ ਹਨ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹਨਾਂ 'ਤੇ ਪਰਮਾਤਮਾ ਦੀ ਬਹੁਤ ਮਿਹਰ ਹੈ ਕਿ ਇਹ ਆਪਣੇ ਕੰਮ ਵਿੱਚ ਇੰਨੇ ਪ੍ਰਪੱਕ ਹਨ ਕਿ ਦੂਰੋਂ ਦੂਰੋਂ ਲੋਕ ਇਹਨਾਂ ਦੀ ਬਣਾਈ ਚੀਜ਼ ਨੂੰ ਦੇਖਣ ਆਉਂਦੇ ਹਨ ਇਹਨਾਂ ਕੋਲ ਇੱਕ ਵਿਲੱਖਣ ਪ੍ਰਤਿਭਾ ਹੁੰਦੀ ਹੈ ਅਤੇ ਇਹ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਵੀ ਹੁੰਦੇ ਹਨ ਪਰ ਜ਼ਿਆਦਾਤਰ ਇਹ ਅੰਤਰਮੁਖੀ ਹੁੰਦੇ ਹਨ ਇਹ ਜ਼ਿਆਦਾ ਬਾਹਲਾ ਗੱਲਬਾਤ ਨਹੀਂ ਕਰਦੇ ਹੁੰਦੇ ਇਹ ਬਸ ਚੁਪ ਰਹਿੰਦੇ ਹਨ ਅਤੇ ਆਪਣੇ ਵੱਲ ਧਿਆਨ ਰੱਖਦੇ ਹਨ ਇਹਨਾਂ ਦੀਆਂ ਕਲਾਕਾਰੀਆਂ ਜਾਂ ਪ੍ਰਦਰਸ਼ਨੀਆਂ ਹਰੇਕ ਨੂੰ ਦੇਖਣੀਆਂ ਚਾਹੀਦੀਆਂ ਹਨ ਕਿਉਂਕਿ ਹਰੇਕ ਕਲਾਕ੍ਰਿਤ ਜਾਂ ਇਹਨਾਂ ਦਾ ਕਰਿਆ ਗਿਆ ਕੰਮ ਜ਼ਿੰਦਗੀ ਦੇ ਕਿਸੇ ਨਾ ਕਿਸੇ ਹਿੱਸੇ ਨੂੰ ਛੂਹੰਦਾ ਹੈ ਅਤੇ ਹਰੇਕ ਇਹਨਾਂ ਦੇ ਹੱਡ ਬੀਤਿਆ ਨੂੰ ਦਰਸਾਉਂਦਾ ਹੈ ਜੋ ਕੁਛ ਇਹ ਦੁਨੀਆਂ ਵਿੱਚ ਦੇਖ ਰਹੇ ਹਨ ਕਲਾਕਾਰ ਦਾ ਦੇਖਣ ਦਾ ਨਜ਼ਰੀਆ ਸਾਰੀ ਦੁਨੀਆਂ ਨਾਲੋਂ ਅਲੱਗ ਹੁੰਦਾ ਹੈ ਕਿਉਂਕਿ ਉਹ ਇੱਕ ਅਲੱਗ ਐਂਗਲ ਤੋਂ ਦੁਨੀਆਂ ਨੂੰ ਦੇਖਦੇ ਹਨ ਅਤੇ ਉਸ ਐਂਗਲ ਤੋਂ ਹੀ ਦੂਜੀ ਦੁਨੀਆਂ ਨੂੰ ਵੀ ਉਸ ਚੀਜ਼ ਨੂੰ ਦੇਖਣ ਵਾਸਤੇ ਪ੍ਰੇਰਿਤ ਕਰਦੇ ਹਨ ਸੋ ਸਾਨੂੰ ਵੱਧ ਤੋਂ ਵੱਧ ਕਲਾਕਾਰਾਂ ਨੂੰ ਮਿਲਣਾ ਚਾਹੀਦੀਆਂ ਹੈ ਵੱਧ ਤੋਂ ਵੱਧ ਪ੍ਰਦਰਸ਼ਨੀਆਂ ਨੂੰ ਦੇਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਮਿਲ ਕੇ ਪਰਸਨਲ ਰੂਪ ਵਿੱਚ ਉਹਨਾਂ ਦੇ ਵਿਅਕਤੀਤਵ ਬਾਰੇ ਜਾਣਨਾ ਚਾਹੀਦਾ ਹੈ ਕਿ ਉਹਨਾਂ ਦੀ ਸੋਚਣੀ ਕੀ ਹੈ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ ਅਤੇ ਉਹ ਆਪਣੀ ਕਲਾ ਨੂੰ ਕਿਵੇਂ ਪ੍ਰਦਰਸ਼ਿਤ ਕਰਦੇ ਹਨ